ਮੈਰਾਥਨ ਦੌੜ ਐਥਲੈਟਿਕਸ ਦਾ ਇੱਕ ਅਨਿਖੜਵਾਂ ਅੰਗ ਹੈ ਮੈਂ ਮੈਰਾਥਾਨ ਦੀ ਤਿਆਰੀ ਕਰ ਰਹੀ ਹਾਂ ਪਰ ਮੈਂ ਹਾਲੇ ਮੈਰਾਥਨ ਵਿੱਚ ਭਾਗ ਨਹੀਂ ਲਿਆ ਮੇਰਾ ਮੈਰਾਥਨ ਦੌੜ ਦੇ ਵਿੱਚ ਬਹੁਤ ਇੰਟਰਸਟ ਹੈ ਐਥਲੈਟਿਕਸ ਦੀਆਂ ਸਭ ਦੌੜਾਂ ਵਿੱਚੋਂ ਇਸ ਦੌੜ ਦਾ ਪੈਂਡਾ ਸਭ ਤੋਂ ਜ਼ਿਆਦਾ ਹੁੰਦਾ ਹੈ ਮੈਰਾਥਨ ਦੌੜ ਦੀ ਲੰਬਾਈ ਬਿਆਲੀ ਪੁਆਇੰਟ ਇੱਕ ਸੌ ਪਚਾਨਵੇਂ ਕਿਲੋਮੀਟਰ ਜਾਂ ਛੱਬੀ ਮੀਲ ਤਿੰਨ ਸੌ ਪਚਾਸੀ ਗੱਜ ਹੈ ਅੱਜ ਕੱਲ੍ਹ ਇਸ ਦੌੜ ਦਾ ਮਰਦ ਵਰਗ ਦਾ ਵਿਸ਼ਵ ਰਿਕਾਰਡ ਕੀਨੀਆਂ ਦੇ ਦੌੜਾਕ ਪੈਟਰਿਕ ਮਕਾਊ ਦੇ ਨਾਂ ਹੈ ਜਿਸਨੇ ਪੱਚੀ ਸਤੰਬਰ ਦੋ ਹਜ਼ਾਰ ਗਿਆਰ੍ਹਾਂ ਨੂੰ ਇਹ ਦੌੜ ਦੋ ਘੰਟੇ ਤਿੰਨ ਮਿੰਟ ਵਿੱਚ ਪੂਰੀ ਕੀਤੀ ਮਹਿਲਾ ਵਰਗ ਦਾ ਵਿਸ਼ਵ ਰਿਕਾਰਡ ਇੰਗਲੈਂਡ ਦੀ ਪਉਲਾ ਰੈਡਕਲਿਫ ਨੇ ਤੇਰ੍ਹਾਂ ਅਪ੍ਰੈਲ ਦੋ ਹਜ਼ਾਰ ਤਿੰਨ ਨੂੰ ਇਹ ਦੌੜ ਦੋ ਘੰਟੇ ਪੰਦਰਾਂ ਮਿੰਟ ਵਿੱਚ ਪੂਰੀ ਕਰਕੇ ਆਪਣਾ ਨਾਂ ਰੌਸ਼ਨ ਕੀਤਾ ਏਸ਼ੀਆ ਮਹਾਂਦੀਪ ਦਾ ਮਰਦ ਵਰਗ ਦਾ ਰਿਕਾਰਡ ਜਪਾਨੀ ਦੌੜਾਕ ਤੋਸ਼ੀ ਨਰੀ ਤਕਾਊਕਾ ਦੇ ਨਾਂ ਹੈ ਜਿਸਨੇ ਦੋ ਹਜ਼ਾਰ ਦੋ ਨੂੰ ਇਹ ਦੌੜ ਦੋ ਘੰਟੇ ਛੇ ਮਿੰਟਾਂ ਦੇ ਵਿੱਚ ਪੂਰੀ ਕੀਤੀ ਸੀ ਪਹਿਲੀਆਂ ਆਧੁਨਿਕ ਓਲੰਪਿਕ ਖੇਡਾਂ ਯੂਨਾਨ ਦੇ ਸ਼ਹਿਰ ਏਥਨਜ਼ ਵਿਖੇ ਅਠਾਰ੍ਹਾਂ ਸੌ ਛਿਆਨਵੇਂ ਨੂੰ ਹੋਈਆਂ ਸੀ ਇਹਨਾਂ ਖੇਡਾਂ ਵਿੱਚ ਵੀ ਇਸ ਦੌੜ ਨੂੰ ਸ਼ਾਮਿਲ ਕੀਤਾ ਗਿਆ ਸੀ ਇਹਨਾਂ ਓਲੰਪਿਕ ਖੇਡਾਂ ਵਿੱਚ ਇਸ ਦੌੜ ਦੀ ਲੰਬਾਈ ਚਾਲ੍ਹੀ ਕਿਲੋਮੀਟਰ ਸੀ ਪਹਿਲੀਆਂ ਓਲੰਪਿਕ ਖੇਡਾਂ ਅਠਾਰ੍ਹਾਂ ਸੌ ਛਿਆਨਵੇਂ ਦੇ ਵਿੱਚ ਉਸ ਤੋਂ ਬਾਅਦ ਉੱਨੀ ਸੌ ਚੌਵੀ ਤੋਂ ਬਾਅਦ ਹੋਈਆਂ ਅੱਜ ਕੱਲ੍ਹ ਇਸ ਦੌੜ ਦਾ ਮਰਦ ਵਰਗ ਦਾ ਰਿਕਾਰਡ ਬਹੁਤ ਲੰਬਾ ਹੈ ਅਤੇ ਮੈਰਾਥਨ ਖੇਡਾਂ ਇੱਕ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦੀਆਂ ਹਨ ਇਹਨਾਂ ਖੇਡਾਂ ਇਹਨਾਂ ਖੇਡਾਂ ਦਾ ਮਨੁੱਖੀ ਜੀਵਨ ਵਿੱਚ ਬਹੁਤ ਅਹਿਮ ਰੋਲ ਹੈ